ਮੈਂ ਆਪਣੀ ਜ਼ਿੰਦਗੀ ਵਿੱਚ ਬਹੁਤ ਹੀ ਘੱਟ ਖਰੀਦਦਾਰੀ ਕੀਤੀ ਹੈ ਤਕਰੀਬਨ ਨਾ ਦੇ ਬਰਾਬਰ ਹੀ ਕਿਉਂਕਿ ਮੇਰੀ ਸਾਰੀ ਖੀ ਖਰੀਦਦਾਰੀ ਮੇਰੇ ਬੱਚੇ ਮੇਰੇ ਹਸਬੈਂਡ ਕਰਦੇ ਨੇ ਪਰ ਇੱਕ ਵਾਰ ਮੈਂ ਵੀ ਕੁਛ ਖਰੀਦਣਾ ਚਾਹਿਆ ਅਤੇ ਗਰਮੀ ਬਹੁਤ ਸੀ ਮੈਂ ਆਪਣੇ ਲਈ ਆਪਣੇ ਕਮਰੇ ਦੇ ਲਈ ਇੱਕ ਪੱਖਾ ਲੈ ਕੇ ਆਈ ਆਪਣੀ ਮਰਜ਼ੀ ਦੇ ਨਾਲ ਅਤੇ ਮੈਂ ਜਦੋਂ ਡਰਦੀ ਡਰਦੀ ਨੇ ਉਹ ਸਾਰੇ ਉਹਦੇ ਵਿਊ ਪੜ੍ਹੇ ਉਹ ਪੱਖਾ ਲਾਇਆ ਤਾਂ ਮੇਰੇ ਦਿਲ ਨੂੰ ਬੜਾ ਸਕੂਨ ਮਹਿਸੂਸ ਹੋਇਆ ਉਹ ਪੱਖਾ ਸਭ ਤੋਂ ਪਹਿਲਾਂ ਤਾਂ ਉਹ ਫਾਈਵ ਸਟਾਰ ਸੀਗਾ ਫਾਈਵ ਸਟਾਰ ਅੱਜ ਕੱਲ੍ਹ ਰੇਟ ਦੇ ਰਹੇ ਆ ਨਾ ਵੀ ਇਹ ਜਿਹੜੇ ਫਾਈਵ ਸਟਾਰ ਪੱਖੇ ਹੁੰਦੇ ਹੈ ਇਹ ਘੱਟ ਬਿਜਲੀ ਖਿੱਚਦੇ ਹੈ ਅਤੇ ਚੰਗਾ ਹੁੰਦਾ ਬਸ ਮੈਨੂੰ ਜਾਣੋ ਪੱਖਾ ਖਰੀਦ ਕੇ ਬੜੀ ਖੁਸ਼ੀ ਮਹਿਸੂਸ ਹੋਈ ਕਿਉਂਕਿ ਇੱਕ ਵਧੀਆ ਚੀਜ਼ ਮੈਂ ਆਪਣੀ ਜ਼ਿੰਦਗੀ ਵਿੱਚ ਪਹਿਲੀ ਵਾਰ ਖਰੀਦੀ